ਰੂਪਨਗਰ ਜ਼ਿਲ੍ਹੇ ਵਿੱਚ ਕਈ ਮਹੱਤਵਪੂਰਨ ਸਥਾਨ ਹਨ ਜਿਨ੍ਹਾਂ ਦੇ ਬਹੁਤ ਜ਼ਿਆਦਾ ਮਹੱਤਤਾ ਹੈ ਮਹੱਤਤਾ ਹੈ ਜਿਵੇਂ ਕਿ ਭੱਠਾ ਸਾਹਿਬ ਠੀਕ ਹੈ ਟਿੱਬੀ ਸਾਹਿਬ ਰਣਜੀਤ ਸਿੰਘ ਬਾਗ ਅਤੇ ਉਰੇ ਇੱਕ ਮਿਊਜ਼ੀਅਮ ਸਥਿਤ ਹੈ ਜੋ ਕਿ ਕਿਸੇ ਦੇ ਕਿਸੇ ਦੇ ਜੀਵਨ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਜਿੱਥੇ ਉਹ ਸਾਨੂੰ ਮੁਫ਼ਤ ਦੇਖਣ ਨੂੰ ਮਿਲਦਾ ਹੈ